ਅਸੀਂ ਆਪਣੇ ਘਰ ਨੂੰ ਸਾਫ ਸੁਥਰਾ ਰੱਖਦੇ ਹਾਂ ਅਤੇ ਅਸੀਂ ਆਪਣੇ ਘਰ ਦੇ ਫਰਸ਼ ਜੋ ਕਿ ਕੱਚਾ ਹੈ ਉਸ ਉੱਪਰ ਗਊ ਦੇ ਗੋਬਰ ਦੀ ਲੇਪ ਕਰਦੇ ਹਾਂ ਜੋ ਕਿ ਸਿਹਤ ਲਈ ਕਾਫੀ ਲਾਭਦਾਇਕ ਹੁੰਦਾ ਹੈ ਕਿਉਂਕਿ ਗਊ ਦੇ ਗੋਬਰ ਦੀ ਵਰਤੋਂ ਕਾਫੀ ਆਯੁਰਵੇਦਿਕ ਲਈ ਵਰਤੀ ਜਾਂਦੀ ਹੈ ਅਤੇ ਇਸ ਨੂੰ